ਭਾਰਤੀ ਸੱਭਿਆਚਾਰ ਦਾ ਵਿਕਾਸ ਸਭ ਤੋਂ ਜ਼ਿਆਦਾ ਖੇਤੀ ਵਿੱਚ ਹੋਇਆ ਹੈ ਅਤੇ ਸ਼ੇਅਰ ਮਾਰਕਿਟਿੰਗ ਇੰਟਰਨੈੱਟ ਬੈਂਕ ਰਾਹੀਂ ਪੈਸਿਆਂ ਦਾ ਭੁਗਤਾਨ ਕਰਨਾ ਬਹੁਤ ਹੀ ਸੌਖਾ ਹੋ ਗਿਆ ਹੈ ਸਾਨੂੰ ਬੈਂਕ ਵਿੱਚ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਸਭ ਕੁਛ ਇੰਟਰਨੈੱਟ ਤੋਂ ਹੀ ਹੋ ਜਾਂਦਾ ਹੈ ਪੈਸੇ ਕੱਢਵਾਉਣ ਤੋਂ ਲੈ ਕੇ ਪੈਸੇ ਜਮ੍ਹਾਂ ਕਰਵਾਉਣ ਤੱਕ ਸਭ ਕੁਝ ਇੰਟਰਨੈੱਟ ਰਾਹੀਂ ਹੋ ਜਾਂਦਾ ਹੈ ਅਤੇ ਇਹ ਬਹੁਤ ਹੀ ਸੌਖਾ ਕੰਮ ਹੈ ਕਿ ਅਸੀਂ ਕਿਤੇ ਵੀ ਕਿਸੇ ਵੀ ਥਾਂ ਇੰਟਰਨੈੱਟ ਰਾਹੀਂ ਪੈਸੇ ਕੱਢਵਾ ਜਾਂ ਜਮ੍ਹਾਂ ਕਰਵਾ ਸਕਦੇ ਹਨ